ਅੱਜ ਕੱਲ੍ਹ ਖ਼ਬਰਾਂ ਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਹੈ ਸਾਡੇ ਆਸੇ ਪਾਸੇ ਕੀ ਹੋ ਰਿਹਾ ਇਹਦੇ ਬਾਰੇ ਸਾਨੂੰ ਪਤਾ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਟੀ ਵੀ ਦੀਆਂ ਖ਼ਬਰਾਂ ਤੋਂ ਪਤਾ ਲੱਗਦਾ ਪਰ ਅੱਜ ਕੱਲ੍ਹ ਮੋਬਾਈਲ ਦੇ ਨਾਲ਼ ਜਾਂ ਹੋਰ ਸ਼ੋਸ਼ਲ ਮੀਡੀਆ ਦੇ ਕਈ ਯੰਤਰ ਐਸੇ ਆ ਗਏ ਨੇ ਜਿਹਦੇ ਨਾਲ਼ ਸਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਵੀ ਘਟਨਾਵਾਂ ਵਾਪਰਦੀਆਂ ਨੇ ਜੋ ਵੀ ਖ਼ਬਰਾਂ ਹੁੰਦੀਆਂ ਨੇ ਸਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੇ ਨਾਲ਼ ਉਹਦੇ ਬਾਰੇ ਜਾਣਕਾਰੀ ਹੋ ਜਾਂਦੀ ਹੈ ਜਿਸ ਤਰ੍ਹਾਂ ਤਕਨਾਲੋਜੀ ਹੈ ਤਾਂ ਮੋਬਾਈਲ ਦੇ ਨਾਲ਼ ਜਾਂ ਹੋਰ ਸ਼ੋਸ਼ਲ ਮੀਡੀਆ ਦੇ ਕਈ ਐਸੇ ਸੋਫ਼ਟਵੇਅਰ ਨੇ ਜਿਹਦੇ ਨਾਲ਼ ਸਾਨੂੰ ਨਵੀਂ ਨਵੀਂ ਤਕਨਾਲੋਜੀ ਬਾਰੇ ਵਿਸ਼ਵੀਕਰਨ ਬਾਰੇ ਜਾਂ ਡਿਜ਼ੀਟਲ ਬਾਰੇ ਪਤਾ ਲੱਗਦਾ ਹੈ ਸਾਡੇ ਆਸੇ ਪਾਸੇ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ ਕਿੱਥੇ ਕੋਈ ਘਟਨਾ ਵਾਪਰੀ ਹੈ ਕਿੱਥੇ ਕੋਈ ਤਰੱਕੀ ਹਾਸਿਲ ਕੀਤੀ ਹੈ ਜਾਂ ਕਿਸੇ ਵੀ ਦੇਸ਼ ਦੇ ਵਿੱਚ ਜੋ ਵੀ ਕੁਛ ਕਾਰਵਾਈ ਹੁੰਦੀ ਹੈ ਸਾਨੂੰ ਉਹਦੇ ਬਾਰੇ ਖ਼ਬਰਾਂ ਰਾਹੀਂ ਪਤਾ ਲੱਗਦਾ ਹੈ